ਸਾਡੇ ਇੱਥੇ ਸ਼ਹਿਰ 'ਚ ਫਤਿਹਗੜ੍ਹ ਸਾਹਿਬ ਵਿਖੇ ਜਾਂ ਕਹਿ ਲਉ ਸਰਹਿੰਦ ਦੇ ਵਿੱਚ ਨਾ ਸ਼ਹੀਦੀ ਹੋਈ ਸੀ ਛੋਟੇ ਸਾਹਿਬਜ਼ਾਦਿਆਂ ਦੀ ਸ਼੍ਰੀ ਗੁਰੂ ਗੋਬਿੰ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦੀ ਸ਼ਹੀਦੀ ਉਰੇ ਹੋਈ ਸੀ ਜਿਸ ਕਰਕੇ ਇੱਥੇ ਤਿੰਨ ਦਿਨ ਗਿਆਰ੍ਹਾਂ ਪੋਹ ਤੋਂ ਲੈ ਕੇ ਤੇਰ੍ਹਾਂ ਪੋਹ ਤੱਕ ਗਿਆਰ੍ਹਾਂ ਬਾਰ੍ਹਾਂ ਤੇਰ੍ਹਾਂ ਪੋਹ ਅਤੇ ਅਖੰਡ ਪਾਠ ਸਾਹਿਬ ਰੱਖੇ ਜਾਂਦਾ ਅਤੇ ਭੋਗ ਪਾਏ ਜਾਂਦੇ ਨੇ ਤੇਰਾ ਪ ਅਤੇ ਇਸ ਤਰ੍ਹਾਂ ਇੱਕ ਮਾਨਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਨਾ ਕਿ ਕੋਈ ਬੈਡਾਂ 'ਤੇ ਨਹੀਂ ਸੌਂਦਾ ਹੈਗਾ ਉੱਪਰ ਨਹੀਂ ਮੰਜਿਆਂ 'ਤੇ ਨਹੀਂ ਸੌਂਦੇ ਹੈਗੇ ਅਤੇ ਜਿਹੜੇ ਇਸ ਮਾਨਤਾ ਨੂੰ ਮੰਨਦੇ ਆ ਉਹ ਕੀ ਕਰਦੇ ਆ ਕਿ ਪਰਾਲੀ ਲਿਆਉਂਦੇ ਆ ਪਰਾਲੀ ਲਿਆ ਕੇ ਉੱਪਰ ਆਪਣੇ ਗਦੈਲੇ ਵਗੈਰਾ ਸੁੱਟ ਲੈਂਦੇ ਆ ਅਤੇ ਉੱਪਰ ਉਹ ਰਜਾਈ ਵਗੈਰਾ ਲੈ ਕੇ ਉੱਥੇ ਜਾਣੀ ਥੱਲੇ ਸੌਂਦੇ ਨੇ ਬੈਡਾਂ 'ਤੇ ਨਹੀਂ ਸੌਂਦੇ ਹੈਗੇ ਕਈ ਵੈਸੇ ਥੱਲੇ ਵਿਛੌਣਾ ਵਿਛਾ ਕੇ ਸੌ ਜਾਂਦੇ ਨੇ ਇਹ ਕਹਿੰਦੇ ਵੀ ਜਦੋਂ ਸਾਹਿਬਜ਼ਾਦੇ ਉਰੇ ਆਏ ਸੀ ਤਾਂ ਉਹਨੂੰ ਠੰਡੇ ਬੁਰਜ 'ਚ ਰੱਖਿਆ ਗਿਆ ਸੀ ਅਤੇ ਉਹਨਾਂ ਨੂੰ ਕੋਈ ਉੱਪਰੋਂ ਗਰਮ ਕੱਪੜਾ ਵੀ ਲੈਣ ਨੂੰ ਨਹੀਂ ਦਿੱਤਾ ਸੀਗਾ ਅਤੇ ਇਸ ਕਰਕੇ ਨਾ ਲੋਕ ਇਹ ਮੰਨਦੇ ਨੇ ਕਿ ਜੇ ਉਹਨਾਂ ਨੇ ਐਨੇ ਤਸੀਹੇ ਝੱਲੇ ਨੇ ਤਾਂ ਅਸੀਂ ਤਿੰਨ ਦਿਨ ਜਾਂ ਇਸ ਮਹੀਨੇ ਥੱਲੇ ਨਹੀਂ ਪੈ ਸਕਦੇ ਹੈਗੇ ਕਿ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਜਿਹੜੀ ਉਹਨਾਂ ਨੇ ਦੇਸ਼ ਵਾਸਤੇ ਦਿੱਤੀ ਸੱਚ ਵਾਸਤੇ ਦਿੱਤੀ ਸਾਡੇ ਧਰਮ ਵਾਸਤੇ ਦਿੱਤੀ ਅਤੇ ਉਸਨੂੰ ਯਾਦ ਕਰਦੇ ਹੋਏ ਜਾਂ ਉਹਦਾ ਸਤਿਕਾਰ ਕਰਦੇ ਹੋਏ ਅਸੀਂ ਇੰਨੀ ਕੁ ਕੁਰਬਾਨੀ ਤਾਂ ਕਰ ਹੀ ਸਕਦੇ ਹਾਂ ਕਿ ਉਹਨਾਂ ਦਿਨਾਂ ਦੌਰਾਨ ਜਾਣੀ ਨਿੱਘੇ ਬੈਡਾਂ ਦੀ ਬਜਾਏ ਅਸੀਂ ਥੱਲੇ ਪੂੰਜੇ ਸੌਂਈਏ ਚਾਹੇ ਥੱਲਿਓ ਠੰਡ ਚੜ੍ਹੇ ਜਿਵੇਂ ਮਰਜ਼ੀ ਹੋਵੇ ਅਤੇ ਇਹ ਇੱਕ ਸਤਿਕਾਰ ਵਜੋਂ ਕਹਿ ਲਉ ਜਾਂ ਇੱਕ ਪਰੰਪਰਾ ਦਾ ਹਿੱਸਾ ਕਹਿ ਲਉ ਅਤੇ ਇਸ ਤਰ੍ਹਾਂ ਕੁਝ ਲੋਕ ਕਰਦੇ ਨੇ ਸਾਰੇ ਤਾਂ ਨਹੀਂ ਕਰਦੇ ਬਟ ਜਿਹੜੇ ਮੰਨਦੇ ਨੇ ਉਹ ਕਰਦੇ ਨੇ